ਹਾਂਜੀ ਹੈਲੋ ਹਾਂਜੀ ਗੁੱਡ ਮੋਰਨਿੰਗ ਹਾਂਜੀ ਹਾਂਜੀ ਤੁਹਾਡਾ ਇੱਥੇ ਡਿਪਾਰਟਮੈਂਟ ਕਿਹੜਾ ਤੁਹਾਡਾ ਅੱਛਾ ਅੱਛਾ ਤੁਹਾਡੀ ਬੇਟਾ ਅਗਲੇ ਸ ਅਗਲੇ ਮਹੀਨੇ ਨਾ ਤੁਹਾਡੀ ਪਲੇਸਮੈਂਟ ਡਰਾਈਵ ਲੱਗੇਗੀ ਅਤੇ ਉਦੋਂ ਤੁਸੀਂ ਬੈਠ ਸਕਦੇ ਹੋ ਉਦੋਂ ਸਾਡੀ ਜੋ ਇੰਨਸ਼ੋਰੈਂਸ ਕੰਪਨੀ ਐਡਮਿਸ਼ਨ ਵੇਲੇ ਤੁਹਾਨੂੰ ਕਿਹਾ ਸੀ ਕਿ ਸਾਰਿਆਂ ਦੀ ਜੋਬ ਲੱਗੇਗੀ ਅਤੇ ਇਸ ਕਰਕੇ ਅਗਲੇ ਮਹੀਨੇ ਤੁਹਾਡੀ ਪਲੇਸਮੈਂਟ ਉਹਦੇ 'ਚ ਤੁਸੀਂ ਬੈਠੋ ਤੁਹਾਡੀ ਜੋਬ ਲੱਗ ਜੇਗੀ ਦੇਖੋ ਬੇਟਾ ਜਿਹੜੀ ਪਹਿਲੇ ਕੰਪਨੀਜ ਆਈਆਂ ਨਾ ਉਹਨਾਂ ਦੇ ਥੋੜ੍ਹੇ ਰਾਊਂਡ ਤੁਸੀਂ ਦੇਖੋ ਕਿ ਪੜ੍ਹਾਈ ਵੱਲ ਧਿਆਨ ਦਿਓ ਤੁਸੀਂ ਇੰਟਰਵਿਊ ਵਗੈਰਾ ਤੁਸੀਂ ਉਹਦੀ ਤਿਆਰੀ ਕਰੋ ਦੇਖੋ ਇੰਟਰਵਿਊ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਤੁਹਾਨੂੰ ਪਤਾ ਅੱਗੇ ਹੀ ਕੰਪਨੀਆਂ ਘੱਟ ਆਉਂਦੀਆਂ ਪਈਆਂ ਕਰੋਨਾ ਕਰਕੇ ਹੈ ਨਾ ਕਰੋਨਾ ਸੀਗਾ ਪਹਿਲੇ ਹੁਣ ਦੇਖੋ ਰਿਸੈਸ਼ਨ ਚੱਲ ਰਿਹਾ ਮਾਰਕੀਟ ਵਿੱਚ ਕੰਪਨੀਆਂ ਘੱਟ ਆ ਰਹੀਆਂ ਅਤੇ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਨਾ ਲਓ ਅਗਲੇ ਮਹੀਨੇ ਤੁਹਾਡੀ ਆਪਾਂ ਡਰਾਈਵ ਹਾਂ ਕੰਪਨੀ ਆਪਾਂ ਹੋਰ ਬੁਲਾਉਂਦੇ ਪਏ ਇਸੇ ਕਰਕੇ ਕਿ ਜਿਹੜੀਆਂ ਲੱਗੀਆਂ ਨੇ ਨੌਕਰੀਆਂ ਹਜੇ ਆਪਾਂ ਉਹਨਾਂ ਨੂੰ ਕੰਪਨੀਆਂ ਨੂੰ ਅਤੇ ਤੁਸੀਂ ਆਪਣੀ ਇੰਟਰਵਿਊ ਦੀ ਤਿਆਰੀ ਪੂਰੀ ਪੱਕੀ ਰੱਖੋ ਅਤੇ ਜੋਬ ਦੀ ਤੁਹਾਨੂੰ ਗਰੰਟੀ ਅਸੀਂ ਦਿੰਦੇ ਹਾਂ ਹਾਂਜੀ ਓਕੇ